ਹਾਂ ਸਾਡੇ ਸਕੂਲਾਂ ਦੇ ਵਿੱਚ ਇਤਿਹਾਸ ਪੜ੍ਹਾਇਆ ਜਾਂਦਾ ਸਕੂਲਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਵੀ ਇਤਿਹਾਸ ਪੜ੍ਹਾਇਆ ਜਾਂਦਾ ਇਹ ਜਿਹੜਾ ਇਤਿਹਾਸ ਆ ਵੱਖਰਾ ਤਾਂ ਕਿਉਂਕਿ ਜਿਹੜੇ ਕਿਤਾਬਾਂ ਦੇ ਵਿੱਚ ਹੁੰਦੇ ਉਹ ਨਹੀਂ ਬਿਆਨ ਕੀਤਾ ਹੁੰਦਾ ਵਾਰ ਕਿਉਂਕਿ ਕਿਤਾਬਾਂ ਦੇ ਵਿੱਚ ਇਤਿਹਾਸ ਵਿਚ ਮਿਲਾਵਟ ਹੁੰਦੀ ਉਹਦੇ ਕਰਕੇ ਵੀ ਵੱਖਰਾ ਤਾਂ ਹੁੰਦਾ ਦਾ ਜਿਹੜੀ ਕਿਤਾਬਾਂ ਦੇ ਵਿਚ ਮਿਲਾਵਟ ਹੁੰਦੀ ਉਹਦੇ ਵੱਲ ਨਹੀਂ ਪਤਾ ਹੁੰਦਾ ਕਿਉਂਕਿ ਵੱਖੋ ਵੱਖਰਾ ਲਿਖਿਆ ਹੁੰਦਾ ਥੋੜ੍ਹੀ ਬਹੁਤੀ ਉਹ 'ਚ ਮਿਲਾਵਟ ਵੀ ਹੁੰਦੀ ਹੈ ਅਤੇ ਜਿਹੜਾ ਇਹ ਮਤਲਬ ਕਿ ਇਤਿਹਾਸ ਆ ਕੋਈ ਵੀ ਘਟਨਾਵਾਂ ਅਤੇ ਆਪਾਂ ਲਾਈਏ ਘਟਨਾਵਾਂ ਲਾਈਏ ਤੀਜਾ ਘੱਲੂਘਾਰਾ ਲਾਈਏ ਚੁਰਾਸੀ ਦਾ ਲਾਈਏ ਉਹਦੇ ਬਾਰੇ ਅਜੇ ਤੱਕ ਕਿਸੇ ਵੀ ਕਿਤਾਬਾਂ ਦੇ ਵਿੱਚ ਬਿਆਨ ਨਹੀਂ ਨਾ ਕਿਤਾਬਾਂ ਦੇ ਵਿੱਚ ਇਤਿਹਾਸ ਲਿਖਿਆ ਸੋ ਇਸ ਕਰਕੇ ਜਿਹੜਾ ਉਹ ਤੀਜਾ ਘੱਲੂਘਾਰਾ ਉਹ ਵੀ ਕਿਤਾਬਾਂ ਦੇ ਵਿੱਚ ਆਉਣਾ ਚਾਹੀਦਾ ਤਾਂ ਜੋ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਹੈ ਅਤੇ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਚੱਲ ਕੇ ਕਿ ਸਾਡਾ ਪਿਛੋਕੜ ਇਤਿਹਾਸ ਕੀ ਹੈ ਅਤੇ ਇੱਕ ਸਭ ਤੋਂ ਵੱਡਾ ਕਿਸਾਨੀ ਅੰਦੋਲਨ ਹੋਇਆ ਸੀ ਪੰਜਾਬ ਦਾ ਸਟੇਟ ਦੇ ਨਾਲ ਉਹਦਾ ਇਤਿਹਾਸ ਵੀ ਸਾਡੇ 'ਚ ਨਹੀਂ ਹੈ ਕਿਉਂਕਿ ਬਹੁਤ ਵੱਡਾ ਅੰਦੋਲਨ ਆ ਉਹਦਾ ਇਤਿਹਾਸ ਵੀ ਨਹੀਂ ਉਹਦਾ ਇਤਿਹਾਸ ਵੀ ਇਹ ਸਾਨੂੰ ਕਿਤਾਬਾਂ ਦੇ ਵਿੱਚ ਹੋਣਾ ਚਾਹੀਦਾ ਅਤੇ ਜੋ ਤਾਂ ਜੋ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਪਤਾ ਚੱਲ ਸਕੇ ਕਿ ਸਾਡੇ ਨਾਲ ਕੀ ਹੋਇਆ ਕਿਸਾਨਾਂ ਨਾਲ ਕੀ ਹੋਇਆ ਧੰਨਵਾਦ